ਹੈਲੋ ਹਾਂਜੀ ਨਮਸਤੇ ਮੈਮ ਹਾਂਜੀ ਮੈਮ ਅਸੀਂ ਨਾ ਬਾਹਰੋਂ ਆਏ ਹਾਂ ਟੂਰਿਸਟ ਅਤੇ ਹਾਂਜੀ ਮੈਂ ਜਾਣਨਾ ਚਾਹੁੰਦੀ ਹਾਂ ਕਿ ਇੱਥੋਂ ਪੰਜਾਬ ਦਾ ਜੋ ਗ੍ਰਾਮੀਣ ਲੋਕ ਹੈ ਉਹਨਾਂ ਦਾ ਰਹਿਣ ਸਹਿਣ ਦਾ ਕਿਸ ਤਰ੍ਹਾਂ ਦਾ ਹੈ ਸਮਾਜਿਕ ਜੀਵਨ ਜਿਸ ਤਰ੍ਹਾਂ ਦਾ ਰਹਿਣ ਸਹਿਣ ਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਹੋਰ ਮੈਮ ਰਹਿਣ ਦਾ ਜਿੱਦਾਂ ਪਹਿਰਾਵਾ ਗੱਲਬਾਤ ਕਰਨ ਦਾ ਤਰੀਕਾ ਹਾਂਜੀ ਹਾਂਜੀ

ਉਹਨਾਂ ਦੇ ਪਹਿਰਾਵਾ ਠੀਕ ਹੈ ਹੋਰ ਇਹਨਾਂ ਦਾ ਪਹਿਰਾਵਾ ਕਿਸ ਤਰ੍ਹਾਂ ਵਾ ਜਾਨੀ ਕਿ ਡਰੈੱਸ ਹਾਂਜੀ ਹਾਂਜੀ ਠੀਕ ਹੈ ਓ ਮੈਮ ਚੱਲੋ ਥੈਂਕ ਯੂ ਓਕੇ ਬਹੁਤ ਵਧੀਆ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਜੀ ਓਕੇ ਮੈਮ